ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਆਰਤੀ ਬੋਲਦੀ ਹਾਂ ਹਾਂਜੀ ਹਾਂਜੀ ਵੈਸੇ ਤਿੰਨ ਦਿਨ ਬਹੁਤ ਹੈਗੇ ਆ ਅਤੇ ਇੱਥੇ ਕਾਫੀ ਜਗ੍ਹਾ ਹੈਗੀਆਂ ਘੁੰਮਣ ਵਾਸਤੇ ਦਰਬਾਰ ਸਾਹਿਬ ਲਾਗੇ ਜਲ੍ਹਿਆਂ ਵਾਲਾ ਬਾਗ ਬੋਡਰ ਸਾਡਾ ਪਿੰਡ ਅਤੇ ਉਹ ਸਾਡਾ ਜਿਹੜਾ ਗਾਈਡ ਹੈਗਾ ਵਾ ਸਾਡਾ ਜਿਹੜਾ ਸਟਾਫ ਦਾ ਮੈਂਬਰ ਆ ਉਹ ਤੁਹਾਨੂੰ ਸਾਰਾ ਗਾਈਡ ਕਰ ਦੇਗਾ ਮੈਂ ਉਹਨੂੰ ਤੁਹਾਡੇ ਨਾਲ ਭੇਜ ਦੂੰਗਾ ਗੱਡੀ ਦੇ ਕੇ ਅਤੇ ਉਹ ਤੁਹਾਨੂੰ ਸਾਰਾ ਸਮਝਾ ਦੇਗਾ ਖਰਚਾ ਤੁਹਾਡਾ ਆ ਜੂਗਾ ਬਾਰ੍ਹਾਂ ਤੋਂ ਪੰਦਰ੍ਹਾਂ ਹਜ਼ਾਰ ਦੇ ਵਿੱਚ ਵਿੱਚ ਹਾਂਜੀ ਠੀਕ ਆ ਹਾਂਜੀ